ਡੇਂਗੂ ਬੁਖਾਰ ਅਤੇ ਮਲੇਰੀਆਂ ਬੁਖਾਰ ਇਹ ਅਜਿਹੀਆਂ ਦੋ ਭਿਆਨਕ ਬਿਮਾਰੀਆਂ ਹਨ ਜਿਹੜੀਆਂ ਕਿ ਬਰਸਾਤ ਦੇ ਮੌਸਮ ਦੇ ਵਿੱਚ ਬਹੁਤ ਹੀ ਅੱਗ ਵਾਂਗ ਤੇਜ਼ੀ ਨਾਲ ਪੰਜਾਬ ਦੇ ਵਿੱਚ ਫੈਲ ਜਾਂਦੀਆਂ ਨੇ ਪੰਜਾਬ ਵਿੱਚ ਵੈਸੇ ਤਾਂ ਬਹੁਤ ਹੀ ਖੁਸ਼ਹਾਲ ਰਹਿੰਦਾ ਹੈ ਪਰ ਜਦੋਂ ਕਦੇ ਬਰਸਾਤ ਦਾ ਮੌਸਮ ਆ ਜਾਂਦਾ ਹੈ ਸਾਵਣ ਮਹੀਨਾ ਆ ਜਾਂਦਾ ਹੈ ਅਤੇ ਸਾਵਣ ਮਹੀਨੇ ਦੇ ਆਉਣ ਦੇ ਨਾਲ ਹੀ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਹਨ

ਬਰਸਾਤ ਖਤਮ ਹੋਣ ਦੇ ਬਾਵਜੂਦ ਸਾਫ ਸਫਾਈ ਨਹੀਂ ਕਰਦੇ ਛੱਤਾਂ ਦੀ ਅਤੇ ਉਹ ਪਾਣੀ ਜਮਾਂ ਇਕੱਠਾ ਹੋਇਆ ਰਹਿੰਦਾ ਹੈ ਉਹੀ ਪਾਣੀ ਜਿਵੇਂ ਦੋ ਤਿੰਨ ਦਿਨ ਤੱਕ ਨਾ ਬਦਲਿਆ ਜਾਵੇ ਉਸਨੂੰ ਨਾ ਟਾਈਰਾਂ ਵਿੱਚੋਂ ਕੱਢਿਆ ਜਾਵੇ ਜਾਂ ਬਾਲਟੀਆਂ ਪੀਪਿਆਂ ਵਿੱਚੋਂ ਬਾਹਰ ਕੱਢਿਆ ਜਾਵੇ ਉਸ ਦੇ ਵਿੱਚ ਡੇਂਗੂ ਦੇ ਵਾਇਰਸ ਪੈਦਾ ਹੋ ਜਾਂਦੇ ਨੇ ਡੇਂਗੂ ਇੱਕ ਅਜਿਹਾ ਮੱਛਰ ਹੈ ਜਿਹੜੇ ਕਿ ਆਮ ਮੱਛਰਾਂ ਤੋਂ ਕਾਫੀ ਹੱਟ ਕੇ ਅਤੇ ਖਤਰਨਾਕ ਹੁੰਦਾ ਹੈ ਇਹ ਮੱਛਰ ਬਰਸਾਤ ਦੇ ਪਾਣੀ ਦੇ ਇਕੱਠੇ ਹੋਣ ਦੇ ਨਾਲ ਬਹੁਤ ਹੀ ਤੇਜ਼ੀ ਦੇ ਨਾਲ ਫੈਲਦਾ ਹੈ ਅਤੇ ਜਨਮ ਲੈਂਦਾ ਹੈ ਇਸਦੇ ਜਨਮ ਲੈਣ ਦੇ ਨਾਲ ਹੀ ਇਹ ਪਾਣੀ 'ਚੋਂ ਪੈਦਾ ਹੋ ਕੇ ਸਾਡੇ ਘਰਾਂ ਦੇ ਵਿੱਚ ਆ ਕੇ ਬੈਠਦਾ ਹੈ ਅਤੇ ਇਸ ਜ਼ਿਆਦਾਤਰ ਸਾਡੀਆਂ ਨੰਗੀਆਂ ਲੱਤਾਂ ਪੈਰਾਂ ਬਾਹਵਾਂ ਅਤੇ ਕਿਸੇ ਵੀ ਨੰਗੇ ਪਾਸੇ 'ਤੇ ਹੀ ਹਮਲਾ ਕਰਦਾ ਹੈ ਇਸ ਦੇ ਲੜਨ ਦੇ ਨਾਲ ਕਾਫੀ ਤੇਜ਼ੀ ਦੇ ਨੇ ਬਿਮਾਰੀ ਦਾ ਵਾਧਾ ਹੁੰਦਾ ਹੈ ਮਲੇਰੀਆ ਮਲੇਰੀਆ ਵੀ ਇਸੇ ਤਰ੍ਹਾਂ ਦੀ ਬਿਮਾਰੀ ਹੈ ਗੰਦੇ ਜੋ ਕਿ ਬਰਸਾਤ ਦੇ ਵਿੱਚ ਹੀ ਗੰਦੇ ਪਾਣੀ ਤੋਂ ਜਾਂ ਗੰਦੇ ਪਾਣੀ ਪੀਣ ਤੋਂ ਜਾਂ ਮੱਛਰ ਦੇ ਪਾਣੀ ਤੋਂ ਹੀ ਮਲੇਰੀਆ ਦੀ ਬਿਮਾਰੀ ਪੈਦਾ ਹੁੰਦੀ ਹੈ ਮਲੇਰੀਏ ਦੇ ਨਾਲ ਮੱਛਰ ਦੇ ਨਾਲ ਸਾਨੂੰ ਪੇਟ ਦੀਆਂ ਬੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਹੈ ਜਿਵੇਂ ਕਿ ਪੇਟ ਖਰਾਬ ਹੋਣ ਦੇ ਨਾਲ ਸਾਨੂੰ ਦਸਤ ਉਲਟੀਆਂ ਇਹਨਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਨੂੰ ਗਰਮੀ ਗਰਮੀਆਂ ਦੇ ਵਿੱਚ ਜ਼ਿਆਦਾਤਰ ਆਪਣੇ ਘਰਾਂ ਨੂੰ ਸਾਫ ਸੁਥਰਾ ਰਹਿਣਾ ਰੱਖਣਾ ਚਾਹੀਦਾ ਹੈ ਬਰਸਾਤ ਦੇ ਮੌਸਮ ਦੇ ਪਾਣੀ ਜਿੱਥੇ ਕਿਤੇ ਵੀ ਸਾਨੂੰ ਨਜ਼ਰ ਆਵੇ ਵੀ ਇਕੱਠਾ ਹੋ ਕੇ ਪਿਆ ਹੈ ਉਹਨੂੰ ਸਾਨੂੰ ਲੱਗਰਜੀ ਨਹੀਂ ਕਰਨੀ ਚਾਹੀਦੀ ਉਸ ਨੂੰ ਗਮਲਿਆਂ ਤੋਂ ਬਾਹਰ ਕੱਢ ਕੇ ਸੁੱਟਣਾ ਚਾਹੀਦਾ ਹੈ ਅਤੇ ਤਾਜ਼ਾ ਪਾਣੀ ਪਾਉਣਾ ਚਾਹੀਦਾ ਹੈ ਇਸ ਤਰ੍ਹਾਂ ਸਾਫ ਸਫਾਈ ਕਰਨ ਦੇ ਨਾਲ ਅਸੀਂ ਕਾਫੀ ਬਿਮਾਰੀਆਂ ਤੋਂ ਅਸੀਂ ਆਪ ਹੀ ਬਚ ਸਕਦੇ ਹਾਂ ਡੇਂਗੂ ਮੱਛਰ ਤੋਂ ਬਣਦਾ ਹੈ ਮੱਛਰ ਤੋਂ ਮਲੇਰੀਆ ਬਣਦਾ ਹੈ ਇਸ ਦੇ ਤੇਜ਼ੀ ਦੇ ਫੈਲਣ ਦੇ ਨਾਲ ਇਹ ਕਾਫੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ ਡੇਂਗੂ ਦੀ ਜ਼ਿਆਦਾ ਵਾਇਰਸ ਪੈਦਾ ਸਰੀਰ 'ਚ ਹੋ ਜਾਣ ਕਰਕੇ ਕਾਫੀ ਜਾਣਿਆਂ ਦੀ ਜਾਨ ਵੀ ਜਾ ਸਕਦੀ ਹੈ ਇਸ ਕਰਕੇ ਸਾਨੂੰ ਇਸ ਬਿਮਾਰੀ ਤੋਂ ਬਚਣ ਲਈ ਸਭ ਤੋਂ ਪਹਿਲਾਂ ਬਰਸਾਤ ਦੇ ਪਾਣੀ ਤੋਂ ਹੀ ਬਾਹਰ ਸੁੱਟਣਾ ਚਾਹੀਦਾ ਹੈ ਅਤੇ ਆਪਣੇ ਘਰ ਦੇ ਆਲੇ ਦੁਆਲੇ ਤੋਂ ਵੀ ਝਾਤੀ ਮਾਰ ਕੇ ਗੰਦੇ ਪਾਣੀ ਨੂੰ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ਅਸੀਂ ਆਪ ਹੀ ਬਿਮਾਰੀਆਂ ਨੂੰ ਵਾਧਾ ਦਿੰਦੇ ਹਾਂ ਅਤੇ ਆਪ ਹੀ ਬਿਮਾਰੀਆਂ ਤੋਂ ਬਚ ਸਕਦੇ ਹਾਂ ਡੇਂਗੂ ਬਿਮਾਰੀ ਬਹੁਤ ਹੀ ਭਿਆਨਕ ਬਿਮਾਰੀ ਹੈ ਅਤੇ ਮਲੇਰੀਆ ਵੀ ਇਹ ਦੋ ਬਿਮਾਰੀਆਂ ਪੰਜਾਬ ਵਿੱਚ ਜ਼ਿਆਦਾ ਤੋਂ ਜ਼ਿਆਦਾਤਰ ਸਾਵਣ ਦੇ ਮਹੀਨੇ ਦੇ ਵਿੱਚ ਹੀ ਪੈਦਾ ਹੁੰਦੀਆਂ ਹਨ ਇਸ ਬਿਮਾਰੀ ਦੇ ਨਾਲ ਪੰਜਾਬ ਵਿੱਚ ਹਰ ਸਾਲ ਲੱਖਾਂ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਇਸ ਕਰਕੇ ਸਾਨੂੰ ਸੰਭਲ ਕੇ ਰਹਿਣਾ ਚਾਹੀਦਾ ਹੈ ਡੇਂਗੂ ਅਤੇ ਮਲੇਰੀਆ ਪੰਜਾਬ ਦੀਆਂ ਇਹੀ ਦੋ ਨਿਕੰਮੀਆਂ ਬਿਮਾਰੀਆਂ ਹਨ ਜਿਹੜੀ ਹਰ ਸਾਲ ਸਾਉਣ ਦੇ ਮਹੀਨੇ ਵਿੱਚ ਲੱਖਾਂ ਦੀ ਜਾਨ ਲੈ ਕੇ ਚਲੀਆਂ ਜਾਂਦੀਆਂ ਹਨ